ਰਸੋਈ ਵਿੱਚ ਵਰਤੇ ਜਾਣ ਵਾਲੇ ਬਰਤਨ ਕੁੱਕਰ ਕੜਾਹੀ ਤਵਾ ਜੱਗ ਗਲਾਸ ਕੌਲੀ ਥਾਲੀ ਆਦਿ ਹਨ ਜਿਨ੍ਹਾਂ ਵਿੱਚ ਅਸੀਂ ਖਾਣਾ ਪਕਾ ਸਕਦੇ ਹਾਂ ਤਵੇ ਉੱਤੇ ਖਾਣਾ ਪਕਾ ਸਕਦੇ ਹੈ ਸਬਜ਼ੀ ਵਗੈਰਾ ਬਣਾ ਸਕਦੇ ਕੁੱਕਰ ਵਿੱਚ ਅਤੇ ਗਲਾਸ ਜੱਗ ਦੀ ਅਸੀਂ ਵਰਤੋਂ ਕਰਦੇ ਹਾਂ ਰਸੋਈ ਵਿੱਚ ਪਤੀਲਾ ਪਤੀਲਾ ਪਤੀਲਾ ਵਗੈਰਾ ਰਸੋਈ ਵਿੱਚ ਹੁੰਦਾ ਆ ਜਿਸ ਵਿੱਚ ਸਬਜ਼ੀ ਸੁਬਜ਼ੀ ਬਣਾਈ ਜਾਂਦੀ ਆ ਅਤੇ ਗਲਾਸ ਨਾਲ ਪਾਣੀ ਪੀਤਾ ਜਾਂਦਾ ਆ ਕੌਲੀ 'ਚ ਸਬਜ਼ੀ ਪਾ ਕੇ ਖਾਧੀ ਜਾਂਦੀ ਆ ਕੜਛੀ ਨਾਲ ਸਬਜ਼ੀ ਬਣਾਈ ਜਾਂਦੀ ਆ ਅਤੇ ਰਸੋਈ ਵਿੱਚ ਕਾਫੀ ਬਰਤਨ ਹੁੰਦੇ ਆ ਜਿਨ੍ਹਾਂ ਦੇ ਅਸੀਂ ਵਰਤੋਂ ਕਰ ਸਕਦੇ ਹਾਂ ਧੰਨਵਾਦ